ਅੱਜ ਕੱਲ੍ਹ ਬਜ਼ੁਰਗ ਲੋਕ ਖੇਡਾਂ ਖੇਡਦੇ ਹਨ ਉਹ ਹੈ ਤਾਸ਼ ਜੋ ਕਿ ਬਜ਼ੁਰਗਾਂ ਦੀ ਬਹੁਤ ਵਧੀਆ ਗੇਮ ਹੈ ਜੋ ਕਿ ਉਹ ਕਿਤੇ ਨਹੀਂ ਸਿਰਫ ਘਰ ਦੇ ਅੰਦਰ ਇੱਕ ਕਮਰੇ ਚਾਰ ਦੀਵਾਰੀ ਦੇ ਅੰਦਰ ਬਹਿ ਕੇ ਆਰਾਮ ਨਾਲ ਖੇਡ ਸਕਦੇ ਹਨ ਜਿਸ ਵਿੱਚ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਅਤੇ ਉਹਨਾਂ ਦਾ ਟਾਈਮ ਵੀ ਵਧੀਆ ਲੰਘ ਜਾਂਦਾ ਹੈ ਤਾਸ਼ ਵਿੱਚ ਉਹ ਆਪਦੇ ਇਕੱਠੇ ਕਰਕੇ ਯਾਰ ਮਿੱਤਰ ਜੋ ਵੀ ਪੁਰਾਣੇ ਉਹਨਾਂ ਨਾਲ ਬੈਠ ਕੇ ਉਹ ਆਰਾਮ ਨਾਲ ਖੇਡ ਸਕਦੇ ਹਨ ਜਿਸ ਵਿੱਚ ਉਹਨਾਂ ਨੂੰ ਕਿਤੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਕਿਤੇ ਭੱਜਣ ਨੱਠਣ ਦੀ ਲੋੜ ਨਹੀਂ ਹੈਗੀ ਅਤੇ ਉਹ ਸਿਰਫ ਇੱਕ ਬੈਠ ਕੇ ਆਪਸ ਦੇ ਵਿੱਚ ਗੱਲਾਂ ਬਾਤਾਂ ਵੀ ਕਰ ਸਕਦੇ ਹਨ ਅਤੇ ਅ ਨਾਲੇ ਖੇਡੀ ਵੀ ਜਾਂਦੇ ਆ ਅਤੇ ਉਹਨਾਂ ਦਾ ਆਪਦਾ ਟਾਈਮ ਪਾਸ ਵੀ ਹੋ ਜਾਂਦਾ ਬਜ਼ੁਰਗ ਲੋਕ ਇਹ ਖੇਡ ਨੂੰ ਬਹੁਤ ਹੀ ਪਸੰਦ ਕਰਦੇ ਹਨ ਅਤੇ ਇਹ ਖੇਡ ਇੱਕ ਬਹੁਤ ਪੁਰਾਣੀ ਖੇਡ ਹੈ ਅੱਜ ਤੋਂ ਬਹੁਤ ਟਾਈਮ ਪਹਿਲਾਂ ਇਹ ਖੇਡੀ ਜਾਂਦੀ ਸੀਗੀ ਅਤੇ ਅੱਜ ਵੀ ਬਜ਼ੁਰਗ ਲੋਕ ਇਹਨੂੰ ਖੇਡਣਾ ਪਸੰਦ ਕਰਦੇ ਹਨ ਕਿਉਂਕਿ ਬਜ਼ੁਰਗ ਲੋਕ ਤਾਸ਼ ਨੂੰ ਬਹੁਤ ਹੀ ਪਸੰਦ ਕਰਦੇ ਹਨ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਇੱਕ ਤਾਸ਼ ਹੀ ਹੁੰਦੀ ਸੀ ਜੋ ਬੰਦਾ ਘਰ ਬੈਠ ਕੇ ਖੇਡਦਾ ਹੁੰਦਾ ਸੀ ਅੱਜ ਕੱਲ੍ਹ ਤਾਂ ਬਹੁਤ ਸਾਰੀ ਖੇਡਾਂ ਆ ਗਈਆਂ ਹਨ ਪਰ ਬਜ਼ੁਰਗ ਉਸਨੂੰ ਨਹੀਂ ਖੇਡ ਸਕਦੇ ਉਹਨਾਂ ਦੀ ਉਮਰ ਇੱਕ ਬਹੁਤ ਹੋ ਜਾਂਦੀ ਹੈ ਉਹ ਭੱਜ ਨੱਠ ਨਹੀਂ ਸਕਦੇ ਜਿਸ ਕਰਕੇ ਉਹਨਾਂ ਨੂੰ ਸਿਰਫ ਘਰ ਬਹਿ ਕੇ ਅਤੇ ਸਭ ਆਰਾਮਦਾਇਕ ਇੱਕ ਕਮਰੇ ਦੇ ਵਿੱਚ ਬਹਿ ਕੇ ਉਹ ਗੇਮ ਹੈ ਇੱਕ ਤਾਸ਼ ਜਿਹੜੀ ਉਹ ਤਾਸ਼ ਨੂੰ ਖੇਡ ਸਕਦੇ ਹਨ ਜਿਸ ਵਿੱਚ ਨਾ ਭੱਜਣਾ ਨਾ ਨੱਠਣਾ ਸਿਰਫ ਬੈਠ ਕੇ ਗੱਲਾਂ ਮਾਰ ਕੇ ਆਪਸ ਦੇ ਵਿੱਚ ਖੇਡਣਾ ਜਿਸ ਨਾਲ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਅਤੇ ਉਹ ਆਪਸ 'ਚ ਘਰ ਬੈਠ ਕੇ ਆਰਾਮ ਨਾਲ ਖੇਡ ਸਕਦੇ ਹਨ ਇਸ ਵਿੱਚ ਦੋ ਜਾਂ ਤਿੰਨ ਜ਼ਿਆਦੇ ਵੀ ਖੇਡ ਸਕਦੇ ਹਨ ਉਸ ਤੋਂ ਜ਼ਿਆਦਾ ਵੀ ਖੇਡ ਸਕਦੇ ਹਨ ਇਸ ਨਾਲ ਬਜ਼ੁਰਗ ਦਾ ਆਰਾਮ ਨਾਲ ਟਾਈਮ ਪਾਸ ਹੋ ਜਾਂਦਾ ਹੈ ਅਤੇ ਉਹ ਆਪਣੀ ਇੱਕ ਜ਼ਿੰਦਗੀ ਦੇ ਕੋਈ ਲਮ੍ਹੇ ਆਪਸ ਦੇ ਵਿੱਚ ਸਾਂਝੇ ਕਰ ਲੈਂਦੇ ਹਨ ਖੇਡਦੇ ਖੇਡਦੇ ਤਾਂ ਇਸ ਖੇਡ ਦੇ ਵਿੱਚ ਬੰਦਾ ਇਮੋਸ਼ਨਲੀ ਵੀ ਅਟੈਚਡ ਹੁੰਦਾ ਹੈ ਤਾਂ ਖੇਡਦੇ ਖੇਡਦੇ ਬੰਦਾ ਆਪਸ ਦੇ ਵਿੱਚ ਆਪਣੇ ਪੁਰਾਣੇ ਸਾਂਝ ਦੀਆਂ ਗੱਲਾਂ ਆਪਸ ਦੇ ਵਿੱਚ ਸਾਂਝੇ ਕਰਦਾ ਹੈ ਜਿਸ ਨਾਲ ਕਿ ਨਾਲ ਪੁਰਾਣੇ ਵਿਚਾਰ ਸਾਂਝੇ ਹੋ ਜਾਂਦੇ ਹਨ ਅਤੇ ਤਾਸ਼ ਦੇ ਤਾਸ਼ ਆਪਣੀ ਗੇਮ ਹੈ ਜੋ ਉਹ ਵੀ ਖੇਡ ਲੈਂਦੇ ਹਨ